ਪੰਜਾਬ ਦੇ ਰਵਾਇਤੀ ਕੱਪੜਿਆਂ ਵਿੱਚ ਕਮੀਜ਼ ਅਤੇ ਸਲਵਾਰਾਂ ਹਨ ਇਸ ਦੀ ਚੁੰਨੀਆਂ ਉੱਤੇ ਵੀ ਕਈ ਅਲੱਗ ਅਲੱਗ ਤਰ੍ਹਾਂ ਦੀਆਂ ਕਢਾਈਆਂ ਕੱਢੀਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਖਰੋਸ਼ੀਆ ਅਤੇ ਜ਼ਰਦੋਜੀ ਦੀ ਕਢਾਈ ਵੀ ਕੱਢੀ ਜਾਂਦੀ ਹੈ ਪੰਜਾਬ ਦੀ ਸਭਿਆਚਾਰੋਂ ਸੱਭਿਆਚਾਰ ਸਭ ਤੋਂ ਅਲੱਗ ਹੈ ਕਿਉਂਕਿ ਇੱਥੇ ਬਹੁਤ ਸਭ ਤੋਂ ਵੱਖਰੇ ਢੰਗ ਦੇ ਕੱਪੜੇ ਬਣਾਏ ਜਾਂਦੇ ਹਨ ਇ ਇਸ ਵਿੱਚ ਮੈਂ ਅਗਰ ਗੱਲ ਕਰਾਂ ਤਾਂ ਫੁੱਲਕਾਰੀ ਸਭ ਤੋਂ ਵੱਧ ਮਸ਼ਹੂਰ ਹੈ ਫੁੱਲਕਾਰੀ ਵੱਖਰੇ ਵੱਖਰੇ ਵੱਖਰੇ ਰੰਗਾਂ ਨਾਲ਼ ਬਣੀ ਹੁੰਦੀ ਹੈ ਇਹ ਬਹੁਤ ਹੀ ਜ਼ਿਆਦਾ ਭਾਰੀ ਹੁੰਦੀ ਹੈ ਅਤੇ ਕਾਫ਼ੀ ਸੁੰਦਰ ਵੀ ਹੁੰਦੀ ਹੈ ਪੰਜਾਬ ਦੀ ਹਰ ਇੱਕ ਕੁੜੀ ਇਸ ਨੂੰ ਲੈਂਦੀ ਹੈ ਇਸ ਤੋਂ ਇਲਾਵਾ ਇਹ ਫੁੱਲਕਾਰੀ ਵਿਆਹ ਦੇ ਮੌਕਿਆਂ 'ਤੇ ਅਤੇ ਤਿਉਹਾਰਾਂ ਵਿੱਚ ਵੀ ਲਈ ਜਾਂਦੀ ਹੈ